ਜਿਵੇਂ ਕਿਵੇਂ ਵੇਖਦੀ ਆਂ ਅਖਬਾਰ ਦੇ ਵਿੱਚ ਜਿਆਦਾਤਰ ਵੱਡੀ ਵੱਡੀ ਨਿਊਜ਼ ਜਿਵੇਂ ਕਿ ਅਮਰੀਕਾ ਜਾਂ ਮੋਦੀ ਯੋਗੀ ਸਾਹਿਬ ਜਾਂ ਕੋਈ ਹੋਰ ਵੱਡੀ ਵੱਡੀ ਜਾਣਕਾਰੀਆਂ ਬਾਰੇ ਹੀ ਅਖਬਾਰਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਸੋਚਣਾ ਤੇ ਵੀ ਚਾਹੀਦਾ ਕਿ ਛੋਟੇ ਮਤਲਵ ਕੀ ਜਿਵੇਂ ਗਰੀਬ ਲੋਕ ਜਾ ਛੋਟੀ ਛੋਟੀ ਚੀਜ਼ਾਂ ਇਹ ਵੀ ਬਹੁਤ ਜਰੂਰੀ ਨੇ ਪਰ ਇਹਨਾਂ ਦੇ ਰਿਲੇਟਿਡ ਕਦੇ ਵੀ ਕਿਸੇ ਵੀ ਅਖਬਾਰ ਦੇ ਵਿੱਚ ਆਈ ਨੀ ਇਕ ਸਿਰਫ ਲੋਕਲ ਅਖਬਾਰ ਜਿਵੇਂ ਲੋਕਲ ਅਖਬਾਰਾਂ ਦੇ ਵਿੱਚ ਹੀ ਛੋਟੀ ਛੋਟੀ ਜਿਹੜੀ ਚੀਜ਼ਾਂ ਨੂੰ ਧਿਆਨ ਦਿੱਤਾ ਜਾਂਦਾ ਵੱਡੇ ਅਖਬਾਰਾਂ ਦੇ ਵਿੱਚ ਇਹ ਵੱਡੀ ਹੀ ਨਿਊਜ਼ ਅਮਰੀਕਾ ਦੀ ਜਾਂ ਕੋਈ ਹੋਰ ਵੱਡੀ ਚੀਜ਼ਾਂ ਜਿਵੇਂ ਆਪਣੇ ਘਟਨਾਵਾਂ ਹੋ ਗਈਆਂ ਜਿਵੇਂ ਜਾਂ ਹੋਰ ਕੋਈ ਕਾਫੀ ਬੜੀ ਹਸਤੀਆਂ ਬਾਰੇ ਮਤਲਬ ਕੀ ਵੀ ਦੱਸਿਆ ਜਾਂਦਾ ਹੈ ਪਰ ਛੋਟੀ ਚੀਜ਼ਾਂ ਬਾਰੇ ਕਦੇ ਵੀ ਕੋਈ ਵੀ ਉਹਨਾਂ ਵਿੱਚ ਨਿਊਜ਼ ਨਹੀਂ ਆਉਂਦੀ ਜਿਹੜੀ ਵੀ ਨਿਊਜ਼ ਆਉਂਦੀ ਏਹ ਉਹ ਹਰ ਜਦੋਂ ਵੀ ਕਦੇ ਵੀ ਵੇਖੀਏ ਤਾਂ ਉਹ ਹਮੇਸ਼ਾ ਵੱਡੇ ਹੀ ਲੋਕਾਂ ਬਾਰੇ ਦਿੱਤੀ ਜਾ ਰਹੀ ਜਿਵੇਂ ਕਿ ਅੰਬਾਨੀ ਸਰ ਹੋ ਗਏ ਜਾਂ ਅਡਾਨੀ ਸਰ ਹੋ ਗਏ ਇਹਨਾਂ ਦੇ ਬਾਰੇ ਹੀ ਦੱਸੀ ਜਾਂਦੀ ਏ ਕਦੇ ਵੀ ਛੋਟੇ ਲੋਕਾਂ ਦੀ ਉਹਨਾਂ ਦੀ ਵੱਲ ਉਹਨਾਂ ਦਾ ਧਿਆਨ ਕਦੇ ਵੀ ਨਹੀਂ ਗਿਆ ਸੋ ਲੋਕਲ ਅਖਬਾਰ ਇੱਕ ਜਿਹੜਾ ਕਿ ਛੋਟੀ ਛੋਟੀ ਚੀਜ਼ਾਂ ਨੂੰ ਇਹ ਚੀਜ਼ ਵੇਖਦਾ ਏ ਤੇ ਉਹ ਹਰ ਜਾਣਕਾਰੀ ਉਹਦੇ ਵਿੱਚ ਹੀ ਦੇਖਣ ਨੂੰ ਹੀ ਮਿਲਦੀ ਏ